ਬੜੀ ਇੱਕ ਹਾਸੋਹੀਣੀ ਗੱਲ ਬਣ ਕੇ ਰਹਿ ਗਈ ਆ ਪੁਰਾਣੀਆਂ ਸਾਡੀਆਂ ਖੇਡਾਂ ਹੁੰਦੀਆਂ ਸੀਗੀਆਂ ਕਬੱਡੀ ਖੁੱਦੋ ਗੁੱਲੀ ਡੰਡਾ ਠੀਕ ਹੈ ਲੰਗੜੀ ਲੱਤ ਹੁਣ ਕੀ ਹੋ ਗਿਆ ਉਹੀ ਖੇਡਾਂ ਉਹੀ ਹੈ ਲੇਕਿਨ ਅਸੀਂ ਉਹਨਾਂ ਦੇ ਜੋ ਵੀ ਹੈ ਨਾਮ ਚੇਂਜ ਕਰਤੇ ਹੁਣ ਸਾਡੇ ਲਈ ਜਿਹੜੀਆਂ ਖੇਡਾਂ ਇੱਕ ਵਪਾਰ ਬਣ ਕੇ ਰਹਿ ਗਿਆ ਖੇਡਾਂ ਹੁੰਦੀਆਂ ਸੀਗੀਆਂ ਆਪਣੀ ਸਿਹਤ ਵਾਸਤੇ ਆਪਣੇ ਸੱਭਿਆਚਾਰ ਵਾਸਤੇ ਹੁਣ ਖੇਡਾਂ ਕੀ ਹੈ ਸਿਰਫ ਪੈਸਾ ਕਮਾਉਣ ਵਾਸਤੇ ਆਈ ਪੀ ਐੱਲ ਜਿਹਨੂੰ ਅਸੀਂ ਇੰਡੀਅਨ ਪ੍ਰੀਮੀਅਮ ਲੀਗ ਕਹਿੰਦੇ ਹੈ ਇੰਗਲਿਸ਼ 'ਚ ਇਹੀ ਖੇਡਾਂ ਸਾਡੇ ਪੰਜਾਬੀਆਂ ਜਿਹਨੂੰ ਕਹਿੰਦੇ ਸੀ ਅਸੀਂ ਪਿੰਡਾਂ 'ਚ ਮੇਲੇ ਲੱਗੇ ਮੇਲਿਆਂ 'ਚ ਖੇਡਾਂ ਕੁਸ਼ਤੀਆਂ ਮੁਕਾਬਲੇ ਉਹ ਖੇਡਾਂ ਹੁੰਦੀਆਂ ਸੀ ਉਹੀ ਹੁਣ ਆਈ ਪੀ ਐੱਲ ਬਣ ਕੇ ਰਹਿ ਗਿਆ ਕਬੱਡੀ ਦਾ ਨਾਂ ਰੱਖ ਤਿਆ ਇੰ ਆਈ ਕੇ ਬੀ ਇੰਡੀਅਨ ਕਬੱਡੀ ਲੀਗ ਇੰਡੀਅਨ ਕ੍ਰਿਕਟ ਲੀਗ ਠੀਕ ਹੈ ਇੰਡੀਅਨ ਵਾਲੀਬਾਲ ਲੀਗ ਇਹ ਅਸੀਂ ਕੀ ਹੈ ਉਹੀ ਖੇਡਾਂ ਸਿਰਫ ਪੈਸਾ ਕਮਾਉਣ ਵਾਸਤੇ ਅਸੀਂ ਉਹਨਾਂ ਦਾ ਨਾਂ ਬਦਲ ਤਾ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਸਾਨੂੰ ਆਪਣਾ ਸੱਭਿਆਚਾਰ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ